ਮੇਰੀ ਪਸੰਦੀਦਾ ਅਭਿਨੇਤਰੀ ਐਸ਼ਵਰੀਆ ਰਾਏ ਹੈ ਔਰ ਮੈਨੂੰ ਉਹ ਇਸ ਲਈ ਪਸੰਦ ਹੈ ਕਿਉਂਕਿ ਉਹਨਾਂ ਦੀਆਂ ਅੱਖਾਂ ਬਹੁਤ ਸੋਹਣੀਆਂ ਹਨ ਔਰ ਉਹ ਉਹਨਾਂ ਦਾ ਫਿਲਮਾਂ ਵਿੱਚ ਕੰਮ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਉਹ ਬੜੀ ਮਿਹਨਤ ਔਰ ਲਗਨ ਦੇ ਨਾਲ ਫਿਲਮਾਂ ਵਿੱਚ ਕੰਮ ਕਰਦੇ ਹਨ ਔਰ ਮੈਂ ਬੜੇ ਚਾਅ ਦੇ ਨਾਲ ਉਹਨਾਂ ਦੀਆਂ ਫਿਲਮਾਂ ਦੇਖਦੀ ਹਾਂ ਔਰ ਉਹਨਾਂ ਦਾ ਮੈਨੂੰ ਉਹਨਾਂ ਦਾ ਕਿਰਦਾਰ ਦੇਵਦਾਸ ਫਿਲਮ ਵਿੱਚ ਮੈਨੂੰ ਬਹੁਤ ਵਧੀਆ ਲੱਗਦਾ ਹੈ ਔਰ ਦੇਵਦਾਸ ਫਿਲਮ ਵਿੱਚ ਉਹਨਾਂ ਨੇ ਪਾਰੋ ਦਾ ਰੋਲ ਕੀਤਾ ਹੈ ਔਰ ਐਸ਼ਵਰੀਆ ਰਾਏ ਜੀ ਆਪਣੇ ਮਿਹਨਤ ਔਰ ਲਗਨ ਦੇ ਨਾਲ ਫਿਲਮਾਂ ਵਿੱਚ ਕੰਮ ਕਰਦੇ ਹਨ ਔਰ ਮੈਨੂੰ ਉਹਨਾਂ ਦੀ ਇਹ ਹੀ ਮਿਹਨਤ ਔਰ ਲਗਨ ਨਾਲ ਕੰਮ ਕਰਨ ਦਾ ਤਰੀਕਾ ਬਹੁਤ ਪਸੰਦ ਹੈ ਔਰ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦੋਂ ਮੈਂ ਉਹਨਾਂ ਦੀਆਂ ਫਿਲਮਾਂ ਦੇਖਦੀ ਹਾਂ ਵੈਸੇ ਤਾਂ ਮੈਨੂੰ ਉਹਨਾਂ ਦੀਆਂ ਸਾਰੀਆਂ ਫਿਲਮਾਂ ਹੀ ਬਹੁਤ ਪਸੰਦ ਹਨ ਪਰ ਮੈਨੂੰ ਜ਼ਿਆਦਾਤਰ ਦੇਵਦਾਸ ਫਿਲਮ ਵਿੱਚ ਉਹਨਾਂ ਦਾ ਪਾਰੋ ਦਾ ਰੋਲ ਬਹੁਤ ਪਸੰਦ ਹੈ